ਜਦੋਂ ਮੈਂ ਕੱਪੜੇ ਧੋਣ ਦੀ ਗੱਲ ਕਰਦਾ ਹਾਂ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਚੰਗੀ ਤਰ੍ਹਾਂ ਧੋਣ ਯਕੀਨੀ ਬਣਾਉਂਦਾ ਹਾਂ ਕੁਛ ਪ੍ਰਕਿਰਿਆ ਹਨ ਜੋ ਕਿ ਇਸ ਵਿੱਚ ਅਪਣਾਉਂਦਾ ਹਾਂ ਕੱਪੜੇ ਚੁਣਨਾ ਪਹਿਲਾਂ ਮੈਂ ਕੱਪੜਿਆਂ ਨੂੰ ਉਹਨਾਂ ਦੇ ਰੰਗ ਅਤੇ ਕਿਸਮਾਂ ਦੇ ਅਨੁਸਾਰ ਵੱਖ ਵੱਖ ਕਰ ਲੈਂਦਾ ਹਾਂ ਵੱਖ ਵੱਖ ਕਰ ਲੈਂਦਾ ਹਾਂ ਤਾਂ ਜੋ ਧੋਣ ਵੇਲੇ ਸਮੇਂ ਰੰਗ ਨਾ ਫਿੱਕਾ ਪਵੇ ਧੋਣ ਦੀ ਪ੍ਰਕਿਰਿਆ ਮੈਂ ਕੁਛ ਡਿਜਰਜੰਟ ਅਤੇ ਪਾਣੀ ਦੀ ਵਰਤੋਂ ਕਰਦਾ ਹਾਂ ਜੋ ਕਿ ਕੱਪੜਿਆਂ ਨੂੰ ਸਾਫ ਅਤੇ ਤਾਜ਼ਾ ਰੱਖਦੇ ਹਨ ਕੁਛ ਹੋਲ ਕੇ ਅਤੇ ਸੰਵੇਦਨਸ਼ੀਲ ਕੱਪੜੇ ਸਪੈਸ਼ਲ ਕਲੀਨ ਨਾਲ ਹੀ ਧੋਣਾ ਪਸੰਦ ਕਰਦਾ ਹਾਂ ਸਕਾਉਣ ਦੀ ਪ੍ਰਕਿਰਿਆ ਸੂਰਜ ਦੀ ਰੌਸ਼ਨੀ ਜੇਕਰ ਮੌਸਮ ਅਨੁਸਾਰ ਜਗ੍ਹਾ ਸੁਵਿਧਾ ਹੈ ਤਾਂ ਮੈਂ ਇਸ ਨੂੰ ਸੂਰਜ ਦੀ ਰੌਸ਼ਨੀ ਨਾਲ ਯਕੀਨੀ ਬਣਾਉਂਦਾ ਹਾਂ ਤਾਂ ਜੋ ਕੱਪੜੇ ਜ਼ਿਆਦਾ ਜ਼ਿਆਦਾ ਨਾਸ ਨਾ ਹੋ ਸਕਣ